ਪੰਜਾਬ ਵਿੱਚ ਕਈ ਪ੍ਰਸਿੱਧ ਧਾਰਮਿਕ ਸਥਾਨਾਂ ਸਥਾਨ ਹਨ ਇਹ ਇੱਥੇ ਬਹੁਤ ਸਾਰੇ ਧਾਰਮਿਕ ਸਥਾਨ ਹਨ ਅਤੇ ਅਸੀਂ ਉੱਥੇ ਜਾ ਕੇ ਬਹੁਤ ਸਾਰੀ ਸੱਭਿਆਚਾਰਕ ਅਤੇ ਪਰੰਪਰਾਗਤ ਜਾਣਕਾਰੀ ਪ੍ਰਾਪਤ ਕਰ ਸਕਦੇ ਹਾਂ ਇੱਥੇ ਬਹੁਤ ਸਾਰੀ ਇਤਿਹਾਸਕ ਜਾਣਕਾਰੀ ਸਾਨੂੰ ਮਿਲ ਸਕਦੀ ਹੈ ਜਿਵੇਂ ਕਿ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਦਾ ਹਲ ਹੋਲਾ ਮਹੱਲਾ ਬਹੁਤ ਹੀ ਮਸ਼ਹੂਰ ਹੈ ਉੱਥੇ ਹੋਲਾ ਮਹੱਲਾ ਮਨਾਇਆ ਜਾਂਦਾ ਹੈ ਹੋਲਾ ਮਹੱਲਾ ਇੱਕ ਇਸ ਕਾਰਨ ਮਨਾਇਆ ਜਾਂਦਾ ਹੈ ਕਿ ਉੱਥੇ ਹ ਗੁਰੂ ਗ ਗੋਬਿੰਦ ਸਿੰਘ ਜੀ ਬੈਠ ਕੇ ਸਿੱਖਾਂ ਦਾ ਜੌਹਰ ਦੇਖਦੇ ਸਨ ਜਿਸ ਕਾਰਨ ਉਹ ਸਿੱਖਾਂ ਦੇ ਸਿੱਖਾਂ ਦੀ ਹੋਲੀ ਦਾ ਹੋਲਾ ਬਣ ਗਿਆ ਅਤੇ ਅਸੀਂ ਹਰਿਮੰਦਰ ਸਾਹਿਬ ਵੀ ਜਾਂਦੇ ਹਾਂ ਹਰਿਮੰਦਰ ਸਾਹਿਬ ਨੂੰ ਗੋਲਡਨ ਟੈਂਪਲ ਵੀ ਕਿਹਾ ਜਾਂਦਾ ਹੈ ਕਿਉਂਕਿ ਉਹ ਪੂਰਾ ਸੋਨੇ ਦਾ ਬਣਿਆ ਹੋਇਆ ਹੈ ਮਹਾਰਾਜਾ ਰਣਜੀਤ ਸਿੰਘ ਨੇ ਗੋਲਡਨ ਟੈਂਪਲ ਵਿੱਚ ਸੋਨੇ ਸੋਨਾ ਪ੍ਰਦਾਨ ਕੀਤਾ ਸੀ ਉਹਨਾਂ ਨੇ ਉੱਥੇ ਸੋਨੇ ਦੀਆਂ ਪਰਤਾਂ ਬਣਾਈਆਂ ਹਨ ਹਰਿਮੰਦਰ ਸਾਹਿਬ ਵਿੱਚ ਬਹੁਤ ਹੀ ਜ਼ਿਆਦਾ ਰ ਭੀੜ ਹੁੰਦੀ ਹੈ ਉੱਥੇ ਬਹੁਤ ਹੀ ਸੰਗਤਾਂ ਸੰਗਤਾਂ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਂਦੀਆਂ ਹਨ ਹਰ ਹਰਿਮੰਦਰ ਸਾਹਿਬ ਇੱਥੇ ਦਾ ਬਹੁਤ ਹੀ ਪ੍ਰਸਿੱਧ ਧਾਰਮਿਕ ਸਥਾਨ ਹੈ